ਹੈਲੋ ਨਮਸਕਾਰ ਮੈਮ ਕਿਆ ਹਾਲ ਚਾਲ ਹ ਠੀਕ ਹੋ ਮੈਂ ਨਾ ਤੁਹਾਡੇ ਸ਼ਹਿਰ ਆਇਆ ਫਾਜਲਕਾ ਤੇ ਮੈਂ ਗੁਰਦੁਆਰੇ ਵਿਜਿਟ ਕਰਨੇ ਨੇ ਕਿਹੜੇ ਕਿਹੜੇ ਮੇਨ ਗੁਰਦੁਆਰਾ ਕਿਹੜੇ ਜਿੱਥੇ ਜਾ ਕੇ ਉਹਦਾ ਆਤਮਿਕ ਸ਼ਾਂਤੀ ਵੀ ਮਿਲੇ ਪਾਠ ਪੂਠ ਵੀ ਚਲਦਾ ਹੋਵੇ ਕੋਈ ਜਿਹੜਾ ਮੈਂ ਇਸ ਵੇਲੇ ਰੇਲਵੇ ਸਟੇਸ਼ਨ ਤੋਂ ਬੋਲ ਰਿਹਾ ਮੈਡਮ ਗੁਰਦੁਆਰਾ ਹਾਂਜੀ ਹਾਂਜੀ ਗਊਸ਼ਾਲਾ ਰੋਡ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਇਹ ਰੇਲਵੇ ਸਟੇਸ਼ਨ ਤੋਂ ਕਿੰਨੀ ਦੂਰ ਪਏਗਾ ਜੀ ਵੱਡਾ ਗੁਰਦੁਆਰਾ ਸਿੰਘ ਸਭਾ ਇੱਕ ਡੇਢ ਕਿਲੋਮੀਟਰ ਹਾ ਡੇਢ ਕਿਲੋਮੀਟਰ ਦੇ ਕਰੀਬ ਚਲੋ ਠੀਕ ਹ ਜੀ ਹਾਂਜੀ ਨਵਾਂ ਬਣਿਆ ਹੋਰ ਇਹਦੇ ਤੋਂ ਇਲਾਵਾ ਕਿਹੜਾ ਰਿਲੇਸ਼ਨ ਦੇਖੋ ਨਜ਼ਦੀਕ ਰਾਹ ਪੈਂਦਾ ਹੋਵੇ ਤਾਂ ਮੈਂ ਕੱਢਦਾ ਜਾਵਾਂ ਉਹ ਵੀ ਗੁਰਦੁਆਰਾ ਹਾਂਜੀ ਹਾਂਜੀ ਹਾਂਜੀ ਫਲਾਈ ਓਵਰ ਜਿਹਾ ਹਾਂਜੀ ਫੁਟਵਰ ਅੱਛਾ ਅੱਛਾ ਠੀਕ ਹੈ ਜੀ ਠੀਕ ਥੈਂਕ ਯੂ ਸੋ ਮਚ ਹੋ ਗਿਆ ਜੀ ਹੋ ਗਿਆ ਓਕੇ ਜੀ